ਹੈਲੋ ਹਾਂਜੀ ਹਾਂਜੀ ਹਾਂਜੀ ਪੈਸਟੀਸਾਈਡ ਦੀ ਸੋਪ ਤੋਂ ਬੋਲਦੇ ਜੀ ਪੈਸਟੀਸਾਈਡ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਨਹੀਂ ਅੱਗੇ ਤਾਂ ਦੇਖੋ ਤੁਸੀਂ ਕਿਹੜਾ ਵੀ ਪਹਿਲੀ ਵਾਰ ਲੈਣੀ ਅੱਗੇ ਵੀ ਆਉਂਦੇ ਰਹਿੰਦੇ ਹੋ ਨਾ ਵੀ ਇਸ ਵਾਰ ਕਿਵੇਂ ਇੱਦਾਂ ਦਾ ਕੁਛ ਹੋ ਗਿਆ ਹਾਂਜੀ ਹਾਂਜੀ ਹੋਰ ਆਪਣੇ ਕਿਹੜਾ ਹੁਣ ਅੱਜ ਕੱਲ੍ਹ ਦਾ ਕਦੋਂ ਦੇ ਆਉਂਦੇ ਹੋ ਹਾਂ ਜੀ ਤੁਸੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਨਾ ਤੁਹਾਡੇ ਤੋਂ ਵੀਰ ਜੀ ਮਾਫੀ ਚਾਹੁੰਦਾ ਉਹ ਅਸਲ ਦੇ ਵਿੱਚ ਨਾ ਮੈਂ ਬਾਹਰ ਗਿਆ ਵਾ ਸੀ ਘੁੰਮਣ ਮਾਤਾ ਦੇ ਅਤੇ ਉਹ ਕਈ ਵਾਰ ਤੁਹਾਨੂੰ ਕਸ ਜਿਹੜੇ ਆਪਣੇ ਕੰਮ ਵਾਲੇ ਮੁੰਡੇ ਤੋਂ ਵੀ ਗਲਤ ਦਿੱਤੀ ਜਾ ਸਕਦੀ ਹੈ ਤੁਸੀਂ ਨਾ ਚਿੰਤਾ ਨਾ ਕਰੋ ਤੁਸੀਂ ਮੇਰੇ ਤੋਂ ਨਾ ਬਦਲਾ ਕੇ ਲੈ ਜਾਇਓ ਠੀਕ ਹੈ ਜੇ ਜਾਂ ਤਾਂ ਬਦਲਾ ਕੇ ਲੈ ਜਾਇਓ ਜੇ ਵਰਤ ਲਿਆ ਕੋਈ ਚੱਕਰ ਨਹੀਂ ਅਤੇ ਮੈਂ ਤੁਹਾਨੂੰ ਹੋਰ ਦੇ ਦੂੰਗਾ ਆਪਣੇ ਘਰ ਵਾਲੀ ਗੱਲ ਹੈਗੀ ਹੈ ਨਾ ਵੀ ਲੈੱਸ ਤਾਂ ਦੇਖੋ ਜੀ ਮੈਂ ਦੇਖੋ ਮੇਰਾ ਵੀ ਘਾਟਾ ਹੀ ਹੋ ਗਿਆ ਨਾ ਵੀ ਇੰਨਾ ਮੈਂ ਤੁਹਾਨੂੰ ਸਾਰਾ ਸਟੋਕ ਦੁਬਾਰਾ ਦੇ ਦੂੰਗਾ ਜੀ ਹੈ ਨਾ ਹੂੰ ਹੂੰ ਹਾਂਜੀ ਹਾਂਜੀ ਮੰਣਦਾ ਚੱਲੋ ਜੀ ਮੈਂ ਗਲਤੀ ਮੰਨਦਾ ਗਾ ਹੂੰ ਬਿਲਕੁਲ ਜੀ ਦੇਖੋ ਹਾਂ ਵੀਰ ਜੀ ਦੇਖੋ ਸਾਡੀ ਵੀ ਮਜਬੂਰੀ ਹੈ ਦੇਖੋ ਮੈਂ ਤੁਹਾਡੇ ਮੰਨਦਾ ਹੈ ਵੀ ਇੰਨਾ ਗਾ ਵੀ ਜਿੰਨਾ ਅਸੀਂ ਤੁਹਾਡਾ ਤੁਸੀਂ ਮੇਰੇ ਤੋਂ ਲੈ ਕੇ ਗਏ ਹੋ ਮਾਲ ਦਸ ਹਜ਼ਾਰ ਦਾ ਵੀ ਦਸ ਹਜ਼ਾਰ ਦਾ ਮੈਂ ਤੁਹਾਨੂੰ ਹੋਰ ਦੇ ਦੇ ਸਕਦਾ ਗਾ ਹੈ ਨਾ ਵੇ ਮੈਂ ਵੀ ਦੇਖੋ ਇੰਨਾ ਮਾਰ ਕਿਵੇਂ ਝੱਲਾਂ ਕੋਈ ਅਤੇ ਆਪਣਾ ਦੇਖੋ ਨਾ ਵੀ ਕਿੰਨੇ ਟੈਮ ਦਾ ਵਾਅ ਕੇ ਇਸ ਲਈ ਕੋਈ ਗੱਲ ਨਹੀ ਚੱਕਰ ਨਾ ਮੰਨੋ ਮੈਂ ਜਿੰਨਾ ਬੀਜ ਅਤੇ ਦਵਾਈ ਮੇਰੇ ਕੋਲੋਂ ਗਈ ਹੈ ਮੈਂ ਉੰਨੀ ਤੁਹਾਨੂੰ ਉੰਨੀ ਫ੍ਰੀ ਦੇ ਦੇਊਂਗਾ ਹੋਰ ਨਹੀਂ ਨਹੀਂ ਨਹੀਂ ਨਹੀਂ ਜਦੋਂ ਹੁਣ ਘਰ ਵਾਲੀ ਗੱਲ ਹੈ ਯਾਰ ਇਹੋ ਜਿਹੇ ਕੰਮ ਕਰੋਂਗੇ ਹਾਂ ਹਾਂ ਨਹੀਂ ਨਹੀਂ ਸਹੀ ਹੂੰ ਹੂੰ ਸਹੀ ਗੱਲ ਆ ਬਾਈ ਹਾਂ ਹਾਂ ਹੂੰ ਹੂੰ ਜੱਟ ਅਤੇ ਸ਼ਾਹੂਕਾਰ ਦਾ ਤਾਂ ਰਿਸ਼ਤਾ ਬਇਆ ਬਣਾਇਆ ਇਹ ਵਿਗਾੜਨਾ ਨਹੀਂ ਚਾਹੀਦਾ ਯਾਰ ਨਹੀਂ ਨਹੀਂ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂ ਹਾਂ ਨਾ ਨਾ ਕੋਈ ਗੱਲ ਨਹੀਂ ਤੁਸੀਂ ਆਇਓ ਬਾਈ ਜੀ ਕੱਲ੍ਹ ਨੂੰ ਆਇਓ ਕਦੋਂ ਮਰਜੀ ਤੁਹਾਡੀ ਆਪਣੀ ਦੁਕਾਨ ਹੈ ਜੀ ਜੀ ਹਾਂ ਚੱਲ ਠੀਕ ਹੈ ਬਾਈ ਓਕੇ ਜੀ